ਅਸੀਂ ਸਾਰੇ ਪੰਜਾਬ ਰਾਜ ਦੇ ਵਸਨੀਕ ਹਾਂ ਅਤੇ ਸਾਡੀ ਮਾਤ ਭਾਸ਼ਾ ਜਿਹੜੀ ਉਹ ਪੰਜਾਬੀ ਹੈ ਅਗਰ ਮਾਤ ਭਾਸ਼ਾ ਦੀ ਗੱਲ ਕੀਤੀ ਜਾਵੇ ਤਾਂ ਕੋਈ ਵੀ ਇਨਸਾਨ ਹੈ ਚਾਹੇ ਉਹਦੇ ਸਭ ਤੋਂ ਵੱਧ ਵਾਧੇ ਅਤੇ ਵਿਕਾਸ ਦੇ ਲਈ ਉਹਦੀ ਮਾਤ ਭਾਸ਼ਾ ਜਿਹੜੀ ਸਭ ਤੋਂ ਜ਼ਿਆਦਾ ਜ਼ਰੂਰੀ ਅਤੇ ਅਹਿਮੀਅਤ ਭਰੀ ਚੀਜ਼ ਹੁੰਦੀ ਹੈ ਅਤੇ ਸਾਡੇ ਪੰਜਾਬੀਆਂ ਦੀ ਜ਼ਿੰਦਗੀ ਦੇ ਵਿੱਚ ਪੰਜਾਬੀ ਭਾਸ਼ਾ ਜਿਹੜੀ ਉਹ ਸਭ ਤੋਂ ਜ਼ਿਆਦਾ ਜ਼ਰੂਰੀ ਅਤੇ ਅਹਿਮੀਅਤ ਭਰਪੂਰ ਚੀਜ਼ ਹੈ ਜੇਕਰ ਅਸੀਂ ਗੱਲ ਕਰੀਏ ਤਾਂ ਪੰਜਾਬ ਦਾ ਜਿਹੜਾ ਵਿਰਸਾ ਉਹ ਬਹੁਤ ਜ਼ਿਆਦਾ ਅਮੀਰ ਹੈ ਇੱਥੋਂ ਦਾ ਸੱਭਿਆਚਾਰ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਵਿਲੱਖਣ ਹੈ ਅਤੇ ਪੰਜਾਬੀ ਭਾਸ਼ਾ ਨੇ ਉਸ ਸੱਭਿਆਚਾਰ ਦੀ ਅਮੀਰਤਾ ਨੂੰ ਵਧਾਉਣ ਦੇ ਵਿੱਚ ਹਮੇਸ਼ਾ ਉਸਦੀ ਸਹਾਇਤਾ ਕੀਤੀ ਹੈ ਜੇਕਰ ਅਸੀਂ ਗੱਲ ਕਰੀਏ ਤਾਂ ਪੰਜਾਬੀ ਭਾਸ਼ਾ ਦੇ ਵਿੱਚ ਸਾਡੇ ਮਿਲਦੇ ਜਿਹੜੇ ਲੋਕ ਕਿੱਸੇ ਨੇ ਕਾਵਿ ਨੇ ਸਾਡੇ ਗੁਰਸਿੱਖ ਨੇ ਜਿਹੜੇ ਉਹਨਾਂ ਦੀਆਂ ਬਾਣੀਆਂ ਨੇਗੀਆਂ ਜਿਹੜੀਆਂ ਉਹਨਾਂ ਦੇ ਰਚੇ ਹੋਏ ਜਿਹੜੇ ਸਲੋਕ ਨੇਗੇ ਅਤੇ ਅਗਰ ਅਸੀਂ ਗੱਲ ਕੀਤੀ ਜਾਵੇ ਤਾਂ ਗਿੱਧਾ ਭੰਗੜਾ ਉਸ ਵਿੱਚ ਵਰਤੀਆ ਜਾਂਦੀਆਂ ਬੋਲੀਆਂ ਹੋਰ ਬਹੁਤ ਸਾਰੀਆਂ ਵੰਨਗੀਆਂ ਨੇਗੀਆਂ ਸਾਰੇ ਸਾਡੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦੇ ਲਈ ਸਾਡੀ ਜਿਹੜੀ ਪੰਜਾਬੀ ਭਾਸ਼ਾ ਉਹਦਾ ਸਭ ਤੋਂ ਵੱਡਾ ਯੋਗਦਾਨ ਹੈ ਬੇਸ਼ੱਕ ਅਸੀਂ ਪੰਜਾਬੀ ਕਿਤੇ ਵੀ ਚੱਲ ਜੀਏ ਕੁਛ ਵੀ ਕਰ ਲਈਏ ਕਿਸੇ ਵੀ ਰਾਜ ਦੇ ਵਿੱਚ ਰਹਿਣ ਲੱਗ ਜੀਏ ਪਰ ਆਪਣੇ ਸੱਭਿਆਚਾਰ ਤੋਂ ਨਹੀਂ ਟੁੱਟ ਸਕਦੇ ਅਤੇ ਇਸ ਸੱਭਿਆਚਾਰ ਤੋਂ ਨਾ ਟੁੱਟਣ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਸਾਡੀ ਮਾਤ ਭਾਸ਼ਾ ਪੰਜਾਬੀ ਹੈ